ਮੋਹਾਲੀ ਸ਼ਹਿਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੋ ਕਿ ਚੰਡੀਗੜ੍ਹ ਦੇ ਦੱਖਣ ਪੱਛਮ ਵਿੱਚ ਸਥਿਤ ਹੈ ਮੋਹਾਲੀ ਜ਼ਿਲ੍ਹੇ ਨੂੰ ਮੇਨ ਤੌਰ 'ਤੇ ਆਈ ਆਈ ਟੀ ਹਬ ਵੱਲੋਂ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਬਹੁਤ ਸਾਰੇ ਟੈਕਨੋਲੋਜੀ ਸੰਬੰਧਿਤ ਉਦਯੋਗ ਹਨ ਅਤੇ ਡਿਲੀਵਰੀ ਸੰਬੰਧਿਤ ਉਦਯੋਗ ਹਨ ਜਿਨ੍ਹਾਂ ਨਾਲ਼ ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਅਤੇ ਸਰਕਾਰ ਨੇ ਮੋਹਾਲੀ ਵਿੱਚ ਜੀਵਨ ਪੱਧਰ ਨੂੰ ਉੱਚਾ ਚੱਕਣ ਲਈ ਬਹੁਤ ਹੀ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਹਨ ਜਿਸ ਤਰ੍ਹਾਂ ਮੋਹਾਲੀ ਅਤੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਵਿਚਕਾਰ ਨੈੱਟਵਰਕ ਬਣਾਉਣ ਲਈ ਸੜਕਾਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਅੰਤਰਰਾਸ਼ਟਰੀ ਸੰਪਰਕ ਨੂੰ ਹੁਲਾਰਾ ਦਿੱਤਾ ਜਾ ਸਕੇ ਮੋਹਾਲੀ ਸ਼ਹਿਰ ਪਹਿਲਾ ਰੂਪਨਗਰ ਜ਼ਿਲ੍ਹੇ ਦਾ ਹਿੱਸਾ ਹੁੰਦਾ ਸੀ ਅਤੇ ਦੋ ਹਜ਼ਾਰ ਛੇ ਵਿੱਚ ਇਸ ਨੂੰ ਵੱਖਰੇ ਜ਼ਿਲ੍ਹੇ ਦਾ ਹਿੱਸਾ ਬਣਾਇਆ ਗਿਆ ਹੈ ਅਤੇ ਇਹਨਾਂ ਉਦਯੋਗਾਂ ਦੇ ਸੰਬੰਧ ਵਿੱਚ ਜਿਹੜੀ ਸਾਨੂੰ ਮੁਸ਼ਕਿਲਾਂ ਆਉਂਦੀਆਂ ਹਨ ਉਹ ਹਨ ਕਿ ਕਿਸੇ ਕਿਸੇ ਜਗ੍ਹਾ ਛੋਟੇ ਰੋਡ ਹਨ ਜਿਨਾਂ ਨਾਲ ਡਿਲੀਵਰੀ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਹਨ ਅਤੇ ਟੈਕਨੋਲੋਜੀ ਖੇਤਰ ਵਿੱਚ ਵੀ ਹਰ ਦਿਨ ਨਵੀਂ ਨਾ ਨਵੀਂ ਟੈਕਨੋਲੋਜੀ ਉਜਾਗਰ ਹੁੰਦੀ ਹੈ ਜਿਸ ਨਾਲ ਪੁਰਾਣੀ ਟੈਕਨੋਲੋਜੀ ਥੋੜ੍ਹੀ ਜਿਹੀ ਢਿੱਲੀ ਪੈ ਜਾਂਦੀ ਹੈ ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਮੋਹਾਲੀ ਜ਼ਿਲ੍ਹੇ ਵਿੱਚ ਇੱਕ ਭਾਰੀ ਕੀਮਤਾਂ ਕਰਕੇ ਵੀ ਉਦਯੋਗਾਂ ਵਿੱਚ ਬਹੁਤ ਜ਼ਿਆਦਾ ਫ਼ਰਕ ਆ ਸਕਦਾ ਹੈ ਜਿਸ ਤਰ੍ਹਾਂ ਕਈ ਜਗ੍ਹਾ ਤਾਂ ਜ਼ਮੀਨਾਂ ਬਹੁਤ ਸਸਤੀਆਂ ਹਨ ਅਤੇ ਕਈ ਜਗ੍ਹਾ ਸ਼ੋਅਰੂਮ ਵਗੈਰਾ ਕਈ ਮਹਿੰਗੇ ਹਨ ਜਿਸ ਨਾਲ਼ ਵੱਡੇ ਵਪਾਰੀ ਤਾਂ ਫੇਰ ਵੀ ਕੰਮ ਕਰ ਸਕਦੇ ਹਨ ਪਰ ਛੋਟੇ ਵਪਾਰੀਆਂ ਨੂੰ ਫੇਰ ਵੀ ਬਹੁਤ ਸੋਚ ਸਮਝ ਕੇ ਚੱਲਣਾ ਪੈਂਦਾ ਹੈ